ਵੈਸੇ ਤਾਂ ਆਪਣੇ ਭਾਰਤ ਵਿੱਚ ਬਹੁਤ ਹੀ ਥਾਵਾਂ ਇਹੋ ਜਿਹੀਆਂ ਹਨ ਦੇਖਣ ਨੂੰ ਜਿੱਥੇ ਬਹੁਤ ਵਧੀਆ ਘੁੰਮਣਾ ਵਧੀਆ ਲੱਗਦਾ ਹੈ ਅਤੇ ਇਸ ਵਿੱਚੋਂ ਇੱਕ ਆਪਾਂ ਇ ਦੋ ਥਾਵਾਂ ਦੀ ਗੱਲ ਕਰਾਂਗੇ ਥਾਂ ਨੰਬਰ ਇੱਕ ਮਾਤਾ ਬੰਗਲਾ ਮੁਖੀ ਜੀ ਮਾਤਾ ਬੰਗਲਾ ਮੁਖੀ ਕਾਂਗੜੇ ਜ਼ਿਲ੍ਹੇ ਦੇ ਵਿੱਚ ਸਥਿਤ ਹਨ ਉਹ ਰਾਵਣ ਦੀ ਕੁੱਲ ਦੇਵੀ ਹਨ ਜਿੱਥੇ ਕੀ ਕੋਈ ਵੀ ਉੱਥੇ ਲੋਕ ਬਹੁਤ ਹੀ ਸੈਲਾਨੀ ਜਾਂਦੇ ਹਨ ਦੂਰ ਦੂਰ ਤੋਂ ਬਹੁਤ ਮੱਥਾ ਟੇਕਣ ਬੰਦੇ ਆਉਂਦੇ ਹਨ ਜ਼ਿਆਦਾਤਰ ਉੱਥੇ ਰਾਜਨੀਤਿਕ ਬੰਦੇ ਹੀ ਜਾਂਦੇ ਹਨ ਮਾਤਾ ਬੰਗਲਾ ਮੁਖੀ ਜੋ ਮਾਤਾ ਹੈ ਉਹ ਰਾਵਣ ਦੀ ਕੁੱਲ ਦੇਵੀ ਹੈ ਜਦੋਂ ਰਾਵਣ ਨੇ ਮਹਾਭਾ ਹਾ ਆਪਣਾ ਰਮਾਇਣ ਦਾ ਯੁੱਧ ਲੜਿਆ ਸੀ ਤਾਂ ਉਹਨਾਂ ਨੇ ਵੀ ਮਾਤਾ ਬੰਗਲਾ ਮੁਖੀ ਦੀ ਅਰਾਧਨਾ ਕੀਤੀ ਸੀ ਅਤੇ ਉਹ ਮਾਤਾ ਬੰਗਲਾ ਮੁਖੀ ਉਹਨਾਂ ਦੀ ਕੁੱਲ ਗੁਰੂ ਸੀ ਕੁੱਲ ਮਾਤਾ ਸੀ ਜਿਸ ਵਿੱਚ ਉਹ ਉਹਨਾਂ ਨੂੰ ਜੋ ਗਿਆਨ ਦੀ ਪ੍ਰਾਪਤੀ ਹੋਈ ਹੈ ਉਹ ਮਾਤਾ ਬੰਗਲਾ ਮੁਖੀ ਨੂੰ ਮੰਨ ਕੇ ਹੋਈ ਹੈ ਅਤੇ ਮਾਤਾ ਬੰਗਲਾ ਮੁਖੀ ਜੀ ਕਾਂਗੜਾ ਦੇ ਵਿੱਚ ਸਥਿਤ ਹਨ ਮਾਤਾ ਬੰਗਲਾ ਮੁਖੀ ਦੇ ਬ ਮੰਦਰ ਦੇ ਵਿੱਚ ਉਹ ਸੈਲਾਨੀ ਜਾਂਦੇ ਹਨ ਜਿਹਨਾਂ ਨੂੰ ਕੋਟਾਂ ਕਚਹਿਰੀਆਂ ਦੇ ਕੇਸ ਦੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਅਤੇ ਆਪਾਂ ਦੂਜੀ ਗੱਲ ਕਰਾਂਗੇ ਬਾਬਾ ਬਾਲਕ ਨਾਥ ਜੀ ਬਾਰੇ ਬਾਬਾ ਬਾਲਕ ਨਾਥ ਜੀ ਉਹ ਇਨਸਾਨ ਹਨ ਜਿਨ੍ਹਾਂ ਨੇ ਆਪਣੀ ਬਾਲ ਅਵਸਥਾ ਦੇ ਵਿੱਚ ਹੀ ਬਹੁਤ ਹੀ ਬੜੇ ਸ਼ਕ ਸ਼ਕਤੀਸ਼ਾਲੀ ਕੰਮ ਕੀਤੇ ਹਨ ਬਾਬਾ ਬਾਲਕਨਾਥ ਜੀ ਆਪਣੇ ਦਿਓਟ ਸਿੱਧ ਨਾਮ ਦੀ ਜਗ੍ਹਾ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹਨ ਇਹ ਜਗ੍ਹਾ ਸ਼ਾਹ ਤਲਾਈਆਂ ਤੋਂ ਪੰਜ ਕਿਲੋਮੀਟਰ ਉੱਪਰਲੇ ਪਾਸੇ ਨੂੰ ਹੈ ਪਹਾੜੀ ਸਾਈਡ ਨੂੰ ਹੈ ਅਤੇ ਉੱਥੇ ਉਹਨਾਂ ਦੇ ਉਹਨਾਂ ਨੇ ਬਾਰ੍ਹਾਂ ਸਾਲ ਨੀਚੇ ਸ਼ਾਹ ਤਲਾਈਆਂ ਦੇ ਵਿੱਚ ਮਾਤਾ ਰਤਨੋ ਜੀ ਦੀਆਂ ਮੱਝਾਂ ਵੀ ਚਰਾਈਆਂ ਹਨ